ਪਾਣੀ ਨੂੰ ਫਿਲਟਰ ਕਰਨ ਅਤੇ ਸ਼ੁੱਧ ਕਰਨ ਲਈ ਵੱਖ ਵੱਖ ਅਭਿਆਸਾਂ ਦੀ ਪਾਲਣਾ ਕੀਤੀ ਜਾਂਦੀ ਹੈ ਸਭ ਤੋਂ ਪਹਿਲਾ ਤਰੀਕਾ ਜਿਹੜਾ ਆਮ ਤੌਰ 'ਤੇ ਪਿੰਡਾਂ ਵਿੱਚ ਵੀ ਵਰਤਿਆ ਜਾਂਦਾ ਹੈ ਉਹ ਹੈ ਕਿ ਪਾਣੀ ਨੂੰ ਉਬਾਲ ਕੇ ਅਸੀਂ ਪਾਣੀ ਨੂੰ ਸ਼ੁੱਧ ਕਰ ਸਕਦੇ ਹਾਂ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਪਾਣੀ ਨੂੰ ਸ਼ੁੱਧ ਕਰਨ ਦਾ ਕਿਉਂਕਿ ਅਸ ਇਹ ਬਾਕੀ ਜਿਹੜੇ ਫਿਲਟਰ ਵਗੈਰਾ ਆਪਾਂ ਲਾਉਂਦੇ ਹਾਂ ਆਪਣੇ ਘਰਾਂ ਵਿੱਚ ਉਹਨਾਂ ਤੋਂ ਵੀ ਵਧੀਆ ਤਰੀਕੇ ਨਾਲ ਪਾਣੀ ਸ਼ੁੱਧ ਕਰਦਾ ਦੂਜਾ ਤਰੀਕਾ ਹੁੰਦਾ ਸਾਡਾ ਜੇ ਪਾ ਪਾਣੀ ਵਿੱਚ ਪਾਣੀ ਵਿੱਚ ਆਪਾਂ ਫਿਟਕਰੀ ਪਾ ਦਈਏ ਤਾਂ ਉਸ ਤਰੀਕੇ ਨਾਲ ਵੀ ਪਾਣੀ ਸਾਫ ਹੋ ਜਾਂਦਾ ਹੈ ਅਤੇ ਸਾਡਾ ਤੀਜਾ ਤਰੀਕਾ ਹੈ ਜਿਹੜਾ ਆਮ ਤੌਰ 'ਤੇ ਹੁਣ ਸਾਨੂੰ ਸ਼ਹਿਰਾਂ ਵਿੱਚ ਵੀ ਮਿਲਦਾ ਹੈ ਸਾਰਿਆਂ ਘਰਾਂ ਵਿੱਚ ਕਿ ਉਹ ਇੱਕ ਪੂਰਾ ਫਿਲਟਰ ਦਾ ਜਿਹੜਾ ਸੈਟਅੱਪ ਹੁੰਦਾ ਹੈ ਉਹ ਘਰਾਂ ਵਿੱਚ ਲਾ ਦਿੱਤਾ ਜਾਂਦਾ ਹੈ ਜਿਸ ਕਰਕੇ ਪਾਣੀ ਸਾਡਾ ਫਿਲਟਰ ਹੋ ਕੇ ਆ ਜਾਂਦਾ ਹੈ ਅਤੇ ਸਭ ਤੋਂ ਆਮ ਤੌਰ 'ਤੇ ਸਾਨੂੰ ਫਿਲਟਰ ਕਰਨ ਦਾ ਟੈਕਨੀਕ ਜਿਹੜੀ ਆ ਸਾਨੂੰ ਮਿਲਦੀ ਆ ਅਤੇ ਬਾਕੀ ਵੀ ਹੋਰ ਤਰੀਕਿਆਂ ਦੇ ਹੋਰ ਤਰੀਕੇ ਹੈਗੇ ਜਿਸ ਨਾਲ ਆਪਾਂ ਆਰਾਮ ਨਾਲ ਆਪਣਾ ਪਾਣੀ ਸ਼ੁੱਧ ਕਰ ਸਕਦੇ ਹਾਂ